ਮੇਰੇ ਖਿਆਲ ਦੇ ਨਾਲ ਅੱਜ ਕੱਲ੍ਹ ਦੇ ਨੌਜਵਾਨ ਬਹੁਤ ਹੀ ਕੁਪੋਸ਼ਣ ਦਾ ਸ਼ਿਕਾਰ ਹੋ ਰਹੇ ਹਨ ਜਿਹਨਾਂ ਦਾ ਮੇਨ ਅਤੇ ਸਿੱਧਾ ਕਾਰਨ ਫਾਸਟ ਫੂਡ ਜੰਕ ਫੂਡ ਵਗੈਰਾ ਹੈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਘਰ ਦੇ ਖਾਣੇ ਦੇ ਇਲਾਵਾ ਬਾਕੀ ਬਾਹਰ ਦਾ ਸਭ ਕੁਝ ਖਾਣਾ ਪਸੰਦ ਹੈ ਜਿਵੇਂ ਕਿ ਜਿਵੇਂ ਕਿ ਸਮੋਸੇ ਹੋ ਗਏ ਪੀਜ਼ਾ ਬਰਗਰ ਜਿਹਨਾਂ ਜੋ ਕਿ ਕੁਪੋਸ਼ਣ ਦਾ ਮੇਨ ਸਮੱਸਿਆ ਦਾ ਕਾਰਨ ਹਨ ਅੱਜ ਕੱਲ੍ਹ ਦੇ ਘਰ ਦੇ ਖਾਣੇ ਵਿੱਚ ਜੋ ਕਿ ਪ੍ਰੋਟੀਨ ਮਿਲਦਾ ਹੈ ਉਹ ਬਾਹਰ ਦੇ ਖਾਣੇ ਵਿੱਚ ਨਹੀਂ ਮਿਲ ਪਾਉਂਦਾ ਜਿਹਨਾਂ ਕਰਕੇ ਮੋਟਾਪਾ ਅਤੇ ਹੋਰ ਵੀ ਬਿਮਾਰੀਆਂ ਨੂੰ ਸ਼ ਦਾ ਨੌਜਵਾਨ ਸ਼ਿਕਾਰ ਹੋ ਰਹੇ ਹਨ ਅਤੇ ਅਸੀਂ ਗੱਲ ਕਰੀਏ ਸਾਫ਼ ਪਾਣੀ ਦੀ ਸਾਫ਼ ਪਾਣੀ ਸਾਡੇ ਇੱਧਰ ਤਾਂ ਮਿਲ ਜਾਂਦਾ ਹੈ ਪਰ ਜਿੱਥੇ ਜਿਨ੍ਹਾਂ ਦੀ ਸਾਈਡ 'ਤੇ ਗੰਦੇ ਨਾਲੇ ਹਨ ਅਤੇ ਅਤੇ ਸੀਵਰੇਜ ਦੀ ਪ੍ਰੋਬਲਮ ਹਨ ਉਹਨਾਂ ਵੱਲ ਬਹੁਤ ਹੀ ਗੰਦਾ ਪਾਣੀ ਆਉਂਦਾ ਹੈ ਜਿਹਨਾਂ ਕਰਕੇ ਬਿਮਾਰੀਆਂ ਦਾ ਬਹੁਤ ਹੀ ਵੱਧ ਬਿਮਾਰੀਆਂ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋ ਰਿਹਾ ਹੈ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਇਹ ਕੁਪੋਸ਼ਣ ਅਤੇ ਗੰਦੇ ਪਾਣੀ ਕਾਰਨ ਹੋ ਰਹੀਆਂ ਬਿਮਾਰੀਆਂ ਬਹੁਤ ਹੀ ਵੱਧ ਰਹੀਆਂ ਹਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਖਿਆਲ ਨਾ ਕਰਦੇ ਹੋਏ ਉਹ ਫਾਸਟ ਫੂਡ ਦਾ ਸੇਵਨ ਤਾਂ ਕਰ ਲੈਂਦੇ ਹਨ ਬਟ ਆਉਣ ਵਾਲੇ ਟਾਈਮ 'ਤੇ ਉਹ ਪਛਤਾ ਪਛਤਾਵੇ ਤੋਂ ਇਲਾਵਾ ਉਹਨਾਂ ਕੋਲ ਕੁਛ ਨਹੀਂ ਰਹਿ ਜਾਂਦਾ ਜਦੋਂ ਕਿ ਉਹਨਾਂ ਦੀ ਸਿਹਤ ਵੱਧ ਜਾਂਦੀ ਹੈ ਮੋਟਾਪਾ ਵੱਧ ਜਾਂਦਾ ਹੈ ਫਿਰ ਉਹਨਾਂ ਨੂੰ ਪਤਲੇ ਹੋਣ ਵਾਸਤੇ ਬਹੁਤ ਹੀ ਜ਼ਿਆਦਾ